ਪੰਜਾਬ ਵਿੱਚ ਸਿੱਖਿਆ ਖੇਤਰ ਵਿੱਚ ਕੰਮ ਕਰਨ ਦੇ ਕਈ ਸਾਰੇ ਮੁੱਖ ਮੌਕੇ ਅਤੇ ਚੁਣੌਤੀਆਂ ਹੁੰਦੀਆਂ ਹਨ ਉਹਨਾਂ ਵਿੱਚੋਂ ਕਈ ਸਾਰੇ ਮੌਕੇ ਹਨ ਜਿਵੇਂ ਕਿ ਸਾਨੂੰ ਬੱਚਿਆਂ ਦੇ ਸਮ ਬੱਚਿਆਂ ਦੇ ਸਾਹਮਣੇ ਹੋਣ ਦਾ ਮੌਕਾ ਹੁੰਦਾ ਹੈ ਉਹਨਾਂ ਕੋ ਨਾਲ ਅਸੀਂ ਰੂਬਰੂ ਹੋ ਸਕਦੇ ਹਨ ਉਹਨਾਂ ਨੂੰ ਕੁਛ ਨਵੀਂ ਚੀਜ਼ਾਂ ਸਿਖਾ ਸਕਦੇ ਹਨ ਜਿਹੜੇ ਕਿ ਉਹਨਾਂ ਨੂੰ ਅੱਗੇ ਜਾ ਕੇ ਬਹੁਤ ਹੀ ਮਦਦ ਕਰਨਗੀਆਂ ਅਸੀਂ ਬੱਚਿਆਂ ਨੂੰ ਉਹ ਚੀਜ਼ਾਂ ਸਿਖਾ ਸਕਦੇ ਹਾ ਹਨ ਜਿਹੜੇ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਮਹਾਨ ਮਨੁੱਖ ਬਣਾ ਸਕਦੀਆਂ ਹਨ ਅਤੇ ਹੋਰ ਵੀ ਕਈ ਸਾਰੇ ਮੌਕੇ ਹਨ ਜਿਵੇਂ ਕਿ ਅਸੀਂ ਬੱਚਿਆਂ ਨੂੰ ਉਹਨਾਂ ਦੀਆਂ ਉਹਨਾਂ ਦੇ ਬੀਤੇ ਕੱਲ੍ਹ ਬਾਰੇ ਦੱਸ ਸਕਦੇ ਹਨ ਉਹਨਾਂ ਦੀਆਂ ਕੀ ਉਹਨਾਂ ਦੀਆਂ ਸ਼ਕਤੀਆਂ ਹਨ ਕੀ ਉਹਨਾਂ ਦੀਆਂ ਕਮਜ਼ੋਰੀਆਂ ਹਨ ਅਤੇ ਉਹ ਕਿਵੇਂ ਆਪਣੀ ਕਮਜ਼ੋਰੀ ਨੂੰ ਉੱਭਰ ਸਕਦੇ ਹਨ ਅਤੇ ਉਹ ਕਿਹੜੀ ਚੀਜ਼ ਹੈ ਜਿਨੂੰ ਉਹ ਫੜ ਕੇ ਇੱਕ ਚੰਗਾ ਮਨੁੱਖ ਬਣ ਸਕਦੇ ਹਨ ਇਹ ਕਈ ਸਾਰੀਆਂ ਚੀਜ਼ਾਂ ਹਨ ਜਿਹੜੀਆਂ ਇੱਕ ਸਿੱਖਿਆ ਖੇਤਰ ਵਿੱਚ ਮੌਕੇ ਦੇ ਰੂਪ 'ਤੇ ਸਾਬਿਤ ਹੁੰਦੀਆਂ ਹਨ ਅਤੇ ਕਈ ਸਾਰੀ ਚੁਣੋਤੀਆਂ ਵੀ ਹਨ ਜਿਵੇਂ ਕਿ ਇਨ੍ਹਾਂ ਕੰਮ ਕਰਨ ਦਿਆ ਸਮਾਂ ਕਈ ਵਾਰੀ ਬਹੁਤ ਹੀ ਲੰਬਾ ਹੋ ਜਾਂਦਾ ਹੈ ਅਤੇ ਕਈ ਵਾਰੀ ਜਿਹੜੀ ਅਸੀਂ ਕਹਿੰਦੇ ਹਨ ਵੇਤਨ ਉਹ ਵੀ ਘੱਟ ਹੁੰਦਾ ਹੈ ਅਤੇ ਬੁਨਿਆਦੀ ਢਾਂਚਾ ਵੀ ਇੰਨਾ ਸਖਸ਼ਮ ਨਹੀਂ ਹੁੰਦਾ ਜਿਸ ਕਾਰਨ ਇਹ ਸਿੱਖਿਆ ਖੇਤਰ ਨੂੰ ਕਈ ਸਾਰੀ ਚੁਣੋਤੀਆਂ ਦੇ ਰੂਪ 'ਚ ਕਹਿੰਦੇ ਹਨ ਕਿ ਅਸਰ ਕਰਦਾ ਹੈ